ਬ੍ਰਮ ਬ੍ਰਹਮੰਡ ਬਾਰੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਲੱਖ ਆਕਾਸ਼ਾਂ ਆਕਾਸ਼ ਲੱਖ ਪਤਾਲਾਂ ਪਤਾਲ ਓੜਕ ਓੜਕ ਭਾਲ ਥਕੇ ਵੇਦ ਕਹਣ ਇਕ ਵਾਤ ਕਿ ਲੋਕ ਲੱਭ ਲੱਭ ਕੇ ਥੱਕ ਚੁੱਕੇ ਕਿ ਬ੍ਰਹਮੰਡ ਵਿੱਚ ਕਿੰਨੀਆਂ ਲੱਖਾਂ ਗਲ ਗਲਸੀਆਂ ਹਨ ਜੋ ਜੋ ਗੱਲਾਂ ਸਾਡੇ ਤੋਂ ਅਜੇ ਤੱਕ ਨਹੀਂ ਸੁਲਝੀਆਂ ਉਹ ਬਾਬਾ ਨਾਨਕ ਸਾਡੇ ਗੁਰੂ ਨਾਨਕ ਦੇਵ ਜੀ ਜੁਗਾਂ ਜੁਗ ਪਹਿਲਾਂ ਹੀ ਦੱਸ ਗਏ ਹਨ ਇਹ ਬ੍ਰਹਮੰਡ ਤਾਂ ਇੰਨਾਂ ਵੱਡਾ ਹੈ ਕਿ ਕੋਈ ਇਸ ਦਾ ਅੰਤ ਨਹੀਂ ਪਾ ਸਕਿਆ ਵਿਗਿਆਨਕ ਕੋਸ਼ਿਸ਼ ਤਾਂ ਕਰ ਰਹੇ ਹਨ ਕਿ ਅਸੀਂ ਧਰਤੀ ਵਰਗੇ ਹੋਰ ਗ੍ਰਹਿ ਲੱਭੀਏ ਪਰ ਇਹ ਅਜੇ ਤੱਕ ਸੰਭਵ ਨਹੀਂ ਹੋ ਸਕਿਆ